ਮੈਂ ਤਾਂ ਜ਼ਿਆਦਾ ਤੌਰ 'ਤੇ ਜਿਵੇਂ ਕਿ ਮੈਨੂੰ ਕਲਾ ਹੱਥ ਵਾਲੀ ਕਲਾ ਬਣਾਉਣ ਦੇ ਵਿੱਚ ਕੋਈ ਟਾਈਮ ਨਹੀਂ ਮਿਲਦਾ ਜਿਵੇਂ ਕਿ ਮੈਂ ਜ਼ਿਆਦਾ ਤੌਰ 'ਤੇ ਤਾਂ ਬੈਲਡਿੰਗ ਸ਼ੋਪ ਦੇ ਵਿੱਚ ਹੀ ਲੱਗਿਆ ਹੋਇਆ ਜਿਵੇਂ ਕਿ ਮੈਂ ਲੋਹੇ ਦੀਆਂ ਚੀਜ਼ਾਂ ਤਾਂ ਲੋਕਾਂ ਨੂੰ ਬਹੁਤ ਬਣਾ ਕੇ ਦਿੱਤੀਆਂ ਨੇ ਇਸ ਕਰਕੇ ਮੈਨੂੰ ਕਲਾ ਦੀਆਂ ਚੀਜ਼ਾਂ ਤਾਂ ਬਹੁਤ ਪਸੰਦ ਨੇ ਜਿਹੜੀਆਂ ਹੱਥ ਨਾਲ਼ ਬਣਾਈਆਂ ਜਾਂਦੀਆਂ ਨੇ ਪਰ ਮੇਰੇ ਕੋਲ ਆਪਣਾ ਬਣਾਉਣ ਦਾ ਟਾਈਮ ਨਹੀਂ ਹੈਗਾ ਅਤੇ ਇਹ ਇਸ ਘਰ ਘਰ ਦੇ ਵਿੱਚ ਸਾਡੇ ਬੱਚੇ ਤਾਂ ਹੱਥ ਨਾਲ਼ ਚੀਜ਼ਾਂ ਬਣਾਉਂਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਚੰਗੀ ਤਰ੍ਹਾਂ ਤੁਸੀਂ ਇਹ ਇਸ ਨੂੰ ਸਿੱਖ ਲਉ ਤਾਂ ਕਿ ਤੁਹਾਡੇ ਇਹ ਕੰਮ ਆਉਣਗੀਆਂ ਅਤੇ ਉਹ ਬਹੁਤ ਵਧੀਆ ਹੀ ਚੀਜ਼ਾਂ ਬਣਾਉਂਦੇ ਨੇ ਜਿਵੇਂ ਕਿ ਕੋਈ ਮੂਰਤੀ ਬਣਾ ਲਈ ਜਾਂ ਕੋਈ ਕੋਈ ਜਾਨਵਰ ਜਿਵੇਂ ਤੋਤੇ ਦੀ ਉਹ ਬਣਾ ਤੀ ਫੋਟੋ ਬਣਾ ਤੀ ਹੋਰ ਐਰਾ ਵਗੈਰਾ ਬਹੁਤ ਕੁਛ ਬਣਾਉਂਦੇ ਨੇ ਜਿਵੇਂ ਕਿ ਉਹਨਾਂ ਵਿੱਚ ਰੰਗ ਵੀ ਭਰਦੇ ਨੇ ਅਤੇ ਵਧੀਆ ਵਧੀਆ ਚੀਜ਼ਾਂ ਬਣਾਉਂਦੇ ਨੇ